ਸਾਡੇ ਕਸਬੇ ਪਿੰਡ ਸ਼ਹਿਰ ਵਿੱਚ ਵਧੀਆ ਹਸਪਤਾਲ ਹੋਣੇ ਚਾਹੀਦੇ ਹਨ ਜੋ ਸਾਡੇ ਲਈ ਬਹੁਤ ਹੀ ਵਧੀਆ ਹੋਣ ਅਤੇ ਇਸ ਹਸਪਤਾਲ ਵਿੱਚ ਇੱਕ ਇੱਕ ਕਮਰੇ ਵਿੱਚ ਕਈ ਕਈ ਨਰਸ ਹੋਣੇ ਚਾਹੀਦੇ ਹਨ ਕਈ ਡਾਕਟਰ ਹੋਣੇ ਚਾਹੀਦੇ ਹਨ ਜੋ ਮਰੀਜ਼ ਦੀ ਦੇਖਭਾਲ ਕਰਨ ਚੰਗੇ ਤਰੀਕੇ ਨਾਲ ਇੱਥੇ ਪਾਣੀ ਵਧੀਆ ਹੋਣਾ ਚਾਹੀਦਾ ਹੈ ਅਤੇ ਮਰੀਜ਼ਾਂ ਦੀ ਦੇਖਭਾਲ ਵੀ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਵਧੀਆ ਹਸਪਤਾਲ ਹੋਣੇ ਚਾਹੀਦੇ ਹਨ ਜੋ ਜੇ ਜਿਸ ਕਰਕੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਇੱਥੇ ਕੋਈ ਪੈਸਾ ਨਾ ਖਰਚ ਹੋਵੇ ਵਧੀਆ ਦਵਾਈ ਮਿਲਣੀ ਚਾਹੀਦੀ ਹੈ ਤਾਂ ਜਿਸ ਨਾਲ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਨੂੰ ਕਿਸੇ ਵੀ ਕੰਮ ਵਾਸਤੇ ਸ਼ਹਿਰ ਨੂੰ ਨਾ ਜਾਣਾ ਪਵੇ ਇਸ ਲਈ ਸਾਡੇ ਇੱਥੇ ਪਿੰਡਾਂ 'ਚ ਬਹੁਤ ਹੀ ਵਧੀਆ ਹਸਪਤਾਲ ਹੋਣੇ ਚਾਹੀਦੇ ਹਨ ਅਤੇ ਇੱਥੇ ਸਕੂਲ ਵੀ ਬਹੁਤ ਹੀ ਵਧੀਆ ਹੋਣੇ ਚਾਹੀਦੇ ਇੱਥੇ ਟੀਚਰ ਹੀ ਬਹੁਤ ਹੀ ਵਧੀਆ ਹੋਣੇ ਚਾਹੀਦੇ ਹਨ ਜੋ ਵਿਦਿਆਰਥੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਣ ਉਹ ਉਹਨਾਂ ਦੇ ਅੱਗੇ ਵਧਣ 'ਚ ਮਿਹਨਤ ਕਰਨ ਇਸ ਲਈ ਸਾਨੂੰ ਇਹ ਉਮੀਦ ਕ ਅਸੀਂ ਇਸ ਲਈ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਧੀਆ ਸਕੂਲ ਹਸਪਤਾਲ ਹੋਣੇ ਚਾਹੀਦੇ ਹਨ ਜਿਸ ਕਰਕੇ ਸਾਨੂੰ ਕੋਈ ਵੀ ਤਕਲੀਫ ਨਾ ਹੋਵੇ ਅਤੇ ਪਾਣੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਧੰ